ਮੇਰੀ ਜ਼ਿੰਦਗੀ 'ਚ ਪਿਛਲਾ ਇੱਕ ਸਾਲ ਬੜਾ ਅਹਿਮ ਰਿਹਾ ਹੈ ਪਹਿਲਾ ਮੈਂ ਜੌਬ ਕਰਦਾ ਸੀਗਾ ਇੱਕ ਵੱਡੇ ਸ਼ਹਿਰ ਵਿੱਚ ਅਤੇ ਉੱਥੋਂ ਮੈਂ ਆ ਕੇ ਆਪਣੇ ਨਿੱਕੇ ਸ਼ਹਿਰ ਵਿੱਚ ਆਪਣਾ ਵਪਾਰ ਸ਼ੁਰੂ ਕੀਤਾ ਹੈ ਜਿਸ ਵਿੱਚ ਮੈਂ ਇੱਕ ਛੋਟੀ ਜਿਹੀ ਕਰਿਆਨੇ ਦੀ ਦੁਕਾਨ ਸ਼ੁਰੂ ਕੀਤੀ ਹੈ ਪਹਿਲਾਂ ਮੇਰੀ ਜ਼ਿੰਦਗੀ ਇੱਕ ਰੌਬਟ ਦੀ ਤਰ੍ਹਾਂ ਹੋ ਗਈ ਸੀ ਸਵੇਰੇ ਸਾਜਰੇ ਜਾਣਾ ਸ਼ਾਮ ਨੂੰ ਆਉਣਾ ਮੇਰੀ ਜ਼ਿੰਦਗੀ 'ਚ ਇੰਨੀ ਜੀ ਖੁਸ਼ੀ ਦੀ ਕੋਈ ਥਾਂ ਨਹੀਂ ਰਹਿ ਗਈ ਸੀ ਪਰ ਆਪਣੇ ਸ਼ਹਿਰ ਵਿੱਚ ਆਉਣ ਕਰਕੇ ਮੈਂ ਆਪਣੇ ਲੋਕਾਂ 'ਚ ਰਹਿੰਦਾ ਹਾਂ ਆਪਣੇ ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰਦਾ ਹਾਂ ਅਤੇ ਉਹਨਾਂ ਨੂੰ ਮੇਰੀ ਕਮ ਦੁਕਾਨ ਦੁਆਰਾ ਕਈ ਸਰਵਿਸਜ਼ ਮੁਹੱਈਆ ਕਰਵਾਈਆਂ ਜਾਂਦੀਆਂ ਜਿਵੇਂ ਇੰਟਰਨੈੱਟ ਦੀ ਸੁਵਿਧਾ ਕਰਿਆਨੇ ਦੀਆਂ ਸਾਰਾ ਸਮਾਨ ਇਸ ਵਿੱਚ ਮੈਨੂੰ ਆਪਣੇ ਘਰ ਨਾਲ਼ ਘਰਦਿਆਂ ਨਾਲ਼ ਰਹਿਣ ਦਾ ਮੌਕਾ ਵੀ ਮਿਲ ਰਿਹਾ ਅਤੇ ਮੈਂ ਖੁਸ਼ੀ ਖੁਸ਼ੀ ਆਪਣਾ ਵਪਾਰ ਵੀ ਕਰ ਰਿਹਾ ਹਾਂ ਅਤੇ ਇਹ ਮੇਰੀ ਜ਼ਿੰਦਗੀ ਦਾ ਅਨੁਭਵ ਬਹੁਤ ਹੀ ਵਧੀਆ ਰਿਹਾ ਹੈ ਪਿਛਲੇ ਇੱਕ ਸਾਲ ਦੌਰਾਨ